ਮੈਂ ਗੱਲ ਕਰਾਂ ਟੈਕਨੋਲਜੀ ਦੀ ਤਾਂ ਟੈਕਨੋਲਜੀ ਸਾਡੇ ਜੀਵਨ ਉੱਤੇ ਬਹੁਤ ਵੱਡਾ ਪ੍ਰਭਾਵ ਪਾ ਰਹੀ ਹੈ ਅੱਗੇ ਅਸੀਂ ਕੋਈ ਵੀ ਸਮਾਨ ਖਰੀਦਣਾ ਹੁੰਦਾ ਸੀ ਤਾਂ ਅਸੀਂ ਦੁਕਾਨਦਾਰ ਕੋਲ ਜਾਂਦੇ ਸੀ ਦੁਕਾਨਦਾਰ ਨੂੰ ਪੈਸੇ ਦਿੰਦੇ ਸੀ ਉਹ ਚੀਜ਼ ਲੈਂਦੇ ਸੀ ਅਤੇ ਘਰ ਆ ਜਾਂਦੇ ਸੀ ਲੇਕਿਨ ਅੱਜ ਸਮਾਂ ਜਿਵੇਂ ਜਿਵੇਂ ਬਦਲ ਰਿਹਾ ਜਿਵੇਂ ਜਿਵੇਂ ਟੈਕਨੋਲਜੀ ਬਦਲ ਰਹੀ ਹੈ ਅਸੀਂ ਪੈਸੇ ਦਾ ਹੱਥ 'ਚ ਰੱਖਣ ਦਾ ਢੰਗ ਖਤਮ ਕਰ ਦਿੱਤਾ ਸਾਡੇ ਕੋਲ ਪੈਸੇ ਹੱਥ ਵਿੱਚ ਸਾਡੇ ਪਰਸ ਦੇ ਵਿੱਚ ਪੈਸੇ ਹੁੰਦੇ ਨਹੀਂ ਪੁਰਾਣੇ ਟਾਈਮ ਵਿੱਚ ਅਗਰ ਸਾਡੇ ਕੋਲ ਹੱਥ 'ਚ ਪੈਸਾ ਹੱਥ 'ਚ ਕੈਸ਼ ਨਹੀਂ ਹੈਗਾ ਤਾਂ ਸਾਡੀ ਸਮਝਿਆ ਜਾਂਦਾ ਸੀ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਲੇਕਿਨ ਅੱਜ ਲੋਕ ਪੈਸਾ ਜੇਬ ਵਿੱਚ ਰੱਖਣਾ ਛੱਡ ਚੁੱਕੇ ਨੇ ਕਿਉਂਕਿ ਜਿਹੜਾ ਸਮਾਂ ਹੈ ਉਹ ਡਿਜਟਲ ਲੈਣ ਦੇਣ ਦਾ ਆ ਗਿਆ ਡਿਜੀਟਲ ਲੈਣ ਦੇਣ ਦਾ ਮਤਲਬ ਕੀ ਹੈ ਸਾਡਾ ਪੈਸਾ ਬੈਂਕ ਵਿੱਚ ਹੀ ਹੈ ਅਤੇ ਬੈਂਕ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਕੀ ਹੋ ਰਿਹਾ ਇੱਕ ਖਾਤੇ ਤੋਂ ਦੂਜੇ ਖਾਤੇ ਦੇ ਵਿੱਚ ਕੀ ਹੋ ਰਿਹਾ ਸ਼ਿਫਟ ਹੋ ਰਿਹਾ ਔਨਲਾਈਨ ਖਰੀਦਦਾਰੀ ਔਨਲਾਈਨ ਖਰੀਦਦਾਰੀ ਦਾ ਮਤਲਬ ਕੀ ਹੈ ਹੁਣ ਜਦੋਂ ਅਸੀਂ ਖਰੀਦਦਾਰੀ ਕਰਨ ਜਾਣਾ ਹੈ ਤਾਂ ਅਸੀਂ ਪੈਸੇ ਨਾਲ ਨਹੀਂ ਲੈ ਕੇ ਜਾਂਦੇ ਅਸੀਂ ਕੀ ਕਰਦੇ ਹਾਂ ਜਦੋਂ ਉੱਥੇ ਖਰੀਦਦਾਰੀ ਕਰਨ ਗਏ ਅਸੀਂ ਜਦੋਂ ਕੋਈ ਵੀ ਚੀਜ਼ ਖਰੀਦਦਾਰੀ ਕਰਨੀ ਹੈ ਅਸੀਂ ਚੀਜ਼ ਖਰੀਦ ਕਰਨੀ ਆ ਉਹ ਉਹਦਾ ਜੋ ਬਿਲ ਬਣਦਾ ਹੈ ਉਹ ਅਸੀਂ ਔਨਲਾਈਨ ਮਾਧਿਅਮ ਰਾਹੀਂ ਔਨਲਾਈਨ ਪੇਮੈਂਟ ਰਾਹੀਂ ਉਹਦਾ ਭੁਗਤਾਨ ਕਰ ਸਕਦੇ ਹਾਂ ਔਨਲਾਈਨ ਪੇਮੈਂਟ ਕਰਨ ਦੇ ਕਈ ਤਰੀਕੇ ਨੇ ਅਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਜੋ ਕਾਰਡ ਸਾਨੂੰ ਬੈਂਕ ਤੋਂ ਮਿਲੇ ਹੋਏ ਨੇ ਡੈਬਿਟ ਕਾਰਡ ਕੀ ਹੁੰਦਾ ਉਹ ਪੈਸਾ ਜਿਹੜਾ ਸਾਡਾ ਬੈਂਕ ਵਿੱਚ ਜਮ੍ਹਾਂ ਹੈ ਉਹ ਪੈਸੇ ਦੀ ਅਸੀਂ ਵਰਤੋਂ ਕਰਦੇ ਹਾਂ ਉਹ ਡੈਬਿਟ ਕਾਰਡ ਹੁੰਦਾ ਕ੍ਰੈਡਿਟ ਕਾਰਡ ਇੱਕ ਤਰ੍ਹਾਂ ਦਾ ਕਰਜ਼ਾ ਹੁੰਦਾ ਜਿਹੜਾ ਬੈਂਕ ਵੱਲੋਂ ਸਾਨੂੰ ਪਹਿਲੇ ਮਿਲਦਾ ਅਸੀਂ ਉਹਨੂੰ ਭਰ ਦਿੰਦੇੇ ਹਾਂ ਅਸੀਂ ਉਹਦਾ ਵਰਤੋਂ ਕਰਨੀ ਅਤੇ ਬਾਅਦ ਵਿੱਚ ਉਹਦੀ ਕੀ ਪੇਮੈਂਟ ਕਰ ਦਿੰਦੇ ਹਾਂ ਹੋਰ ਹੋਰ ਔਨਲਾਈਨ ਪੇਮੈਂਟ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਕੱਲ੍ਹ ਔਨਲਾਈਨ ਦੀ ਹੋਰ ਪੇਮੈਂਟ ਕੀ ਹੈ ਉੱਥੇ ਸਕੈਨਰ ਲੱਗਿਆ ਹੁੰਦਾ ਬਾਰਕੋਡ ਲੱਗਿਆ ਹੁੰਦਾ ਅਸੀਂ ਬਾਰਕੋਡ ਨੂੰ ਸਕੈਨ ਕਰਦੇ ਹਾਂ ਅਤੇ ਸਾਡੇ ਜਿਹੜੇ ਵੈਲਿਟ ਦੇ ਵਿੱਚ ਕਾਰਡ ਵੋਲਟ ਦੇ ਵਿੱਚ ਪੈਸੇ ਹੁੰਦੇ ਨੇ ਗੂਗਲ ਪੇ ਹੋ ਗਿਆ ਫੋਨਪੇ ਹੋ ਗਿਆ ਪੇਟੀਐਮ ਹੋ ਗਿਆ ਅਸੀਂ ਕਿਸੇ ਵੀ ਮਾਧਿਅਮ ਦੇ ਰਾਹੀਂ ਉਹ ਭੁਗਤਾਨ ਕਰ ਸਕਦੇ ਹਾਂ ਉਹ ਜਦੋਂ ਭੁਗਤਾਨ ਕਰਦੇ ਹਾਂ ਸਾਡੇ ਖਾਤੇ ਦੇ ਵਿੱਚੋਂ ਪੈਸੇ ਉਹਦੇ ਖਾਤੇ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਸਾਨੂੰ ਇੱਕ ਮੈਸੇਜ ਆ ਜਾਂਦਾ ਕਿ ਤੁਹਾਡਾ ਭੁਗਤਾਨ ਹੋ ਗਿਆ ਤਾਂ ਉਹਦੇ ਖਾਤੇ ਦੇ ਵਿੱਚ ਪੈਸੇ ਚਲੇ ਜਾਂਦੇ ਨੇ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਨਾ ਸਾਨੂੰ ਪੈਸਾ ਨਾਲ ਰੱਖਣਾ ਪੈਂਦਾ ਨਾ ਪੈਸਾ ਨਾਲ ਲੈ ਕੇ ਜਾਣਾ ਪੈਂਦਾ ਅਸੀਂ ਕੀ ਹੈ ਔਨਲਾਈਨ ਹੀ ਇੱਕ ਦੂਜੇ ਦਾ ਭੁਗਤਾਨ ਕਰ ਰਹੇ ਹਾਂ